ਭਾਰਤ ਇੱਕ ਬਹੁਤ ਸੱਭਿਆਚਾਰਕ ਦੇਸ਼ ਹੈ ਇੱਥੇ ਕਈ ਸੱਭਿਆਚਾਰਕ ਪਰੰਪਰਾਵਾਂ ਪਾਈਆਂ ਜਾਂਦੀਆਂ ਹਨ ਇਸਦੇ ਵੱਖ ਵੱਖ ਖਿੱਤਿਆਂ ਵਿੱਚ ਵੱਖ ਵੱਖ ਸੱਭਿਆਚਾਰ ਮੌਜੂਦ ਹਨ ਜਿਵੇਂ ਦੱਖਣ ਵਿੱਚ ਅਲੱਗ ਸੱਭਿਆਚਾਰ ਹੈ ਉੱਤਰ ਵਿੱਚ ਅਲੱਗ ਸੱਭਿਆਚਾਰ ਹੈ ਇਸ ਤਰ੍ਹਾਂ ਉੱਤਰ ਪੂਰਬ ਵਿੱਚ ਅਲੱਗ ਸੱਭਿਆਚਾਰ ਦਿਸਦੇ ਹਨ ਇਸ ਦੇਸ਼ ਦੀਆਂ ਸੱਭਿਆਚਾਰਕ ਪਰੰਪਰਾਵਾਂ ਵਿੱਚ ਉੱਥੋਂ ਦਾ ਪਹਿਰਾਵਾ ਖਾਣ ਪੀਣ ਬੋਲੀ ਅਤੇ ਹੋਰ ਕਈ ਨਾਚ ਵੀ ਆਉਂਦੇ ਹਨ ਜੋ ਕਿ ਭਾਰਤ ਨੂੰ ਬਾਕੀ ਦੇਸ਼ਾਂ ਨਾਲੋਂ ਵੱਖਰਾ ਕਰਦੇ ਹਨ ਇਥੋਂ ਦੀਆਂ ਸੱਭਿਆਚਾਰਕ ਪਰੰਪਰਾਵਾਂ ਵਿੱਚ ਵੱਡਿਆਂ ਦਾ ਆਦਰ ਸਤਿਕਾਰ ਅਤੇ ਬੱਚਿਆਂ ਨੂੰ ਪਿਆਰ ਇਹੋ ਜਿਹੀਆਂ ਪਰੰਪਰਾਵਾਂ ਪਾਈਆਂ ਜਾਂਦੀਆਂ ਹਨ